ਇੱਕੀ ਸਤੰਬਰ ਉੱਨੀ ਸੌ ਇਕਾਸੀ ਛੇ ਜੂਨ ਅਠਾਰ੍ਹਾਂ ਸੌ ਚੌਵੀ ਪੰਜ ਜਨਵਰੀ ਦੋ ਹਜ਼ਾਰ ਦੋ ਵੀਹ ਫਰਵਰੀ ਦੋ ਹਜ਼ਾਰ ਦਸ ਪੰਦਰ੍ਹਾਂ ਮਈ ਉੱਨੀ ਸੌ ਸੰਨਤਾਲੀ